ਗੈਸ ਸਿਲੰਡਰ ਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਸਤੇਮਾਲ ਕਰਨ ਲਈ ਕੁਝ ਮੁੱਢਲੇ ਹਿਸਾਬਦਾਨੀਆਂ ਹਨ ਪਹਿਲਾ ਸਿਲੰਡਰ ਦੀ ਚੋਣ ਸਹੀ ਆਕਾਰ ਆਪਣੇ ਘਰ ਦੀ ਲੋੜ ਅਨੁਸਾਰ ਸਿਲੰਡਰ ਦਾ ਆਕਾਰ ਚੁਣੋ ਗੁਣਵੱਤਾ ਪ੍ਰਮਾਣਿਤ ਅਤੇ ਮਨਜ਼ੂਰ ਸ਼ੁਧਾ ਸਿਲੰਡਰ ਖਰੀਦੋ ਸਥਾਨ ਦੀ ਚੋਣ ਵਾਯੂਗੋਲਕ ਪਦਾਰਥ ਸਿਲੰਡਰ ਨੂੰ ਖੁੱਲ੍ਹੀ ਜਗ੍ਹਾ 'ਤੇ ਰੱਖੋ ਜਿੱਥੇ ਹਵਾ ਚੱਲ ਸਕਦੀ ਹੈ ਸੂਰਜੀ ਰੌਸ਼ਨੀ ਅਤੇ ਤਾਪ ਸਿਲੰਡਰ ਨੂੰ ਸੂਰਜ ਦੀ ਸਿੱਧੀ ਰੌਸ਼ਨੀ ਅਤੇ ਤਾਪ ਦੇ ਸਾਥੋਂ ਦੂਰ ਰੱਖੋ ਸੁਰੱਖਿਆ ਉਪਕਰਣ ਗੈਸ ਲੀਕ ਘਰ ਵਿੱਚ ਗੈਸ ਲੀਕ ਦੀ ਪਛਾਣ ਲਈ ਡਿਟੈਕਟਰ ਲਗਵਾਓ ਅੱਗ ਬੁਝਾਉਣ ਵਾਲਾ ਅੱਗ ਦੀ ਹਾਦਸੇ ਲਈ ਨਜ਼ਦੀਕੀ ਅੱਗ ਬੁਝਾਉਣ ਵਾਲਾ ਉਪਕਰਨ ਰੱਖੋ ਜੁੜਾਈ ਅਤੇ ਵਰਤੋ ਜੁੜਾਈ ਗੈਸ ਪਾਇਪ ਨੂੰ ਸਹੀ ਤਰ੍ਹਾਂ ਜੋੜੋ ਕੋਈ ਢਿੱਲ ਨਹੀਂ ਹੋਣੀ ਚਾਹੀਦੀ ਵੈਲਵ ਦੀ ਜਾਂਚ ਇਸਤੇਮਾਲ ਕਰਨ ਤੋਂ ਪਹਿਲਾਂ ਵੈਲਵ ਨੂੰ ਚੈੱਕ ਕਰੋ ਕਿ ਉਹ ਠੀਕ ਕੰਮ ਕਰ ਰਹੇ ਹਨ ਬਰਤਨ ਦੇ ਦੌਰਾਨ ਹਵਾਈ ਡਿਸਟੀ ਜਦੋਂ ਵੀ ਸਿਲੰਡਰ ਚਲਾਉਂਦੇ ਹੋ ਗੈਸ ਦੇ ਵੱਡੇ ਖੁੱਲ੍ਹੇ ਸਥਾਨ 'ਤੇ ਹੀ ਰੱਖੋ ਸਮਰਥਨ ਗੈਸ ਸਿਲੰਡਰ ਨੂੰ ਕਦੇ ਵੀ ਉਲਟਾਉਣ ਜਾਂ ਰੁਕਣ ਨਾ ਦੇਣਾ ਛੇਵਾਂ ਸਿਲੰਡਰ ਦੀ ਭਰਾਈ ਭਰਾਈ ਸਥਾਨ ਸਿਲੰਡਰ ਨੂੰ ਕੇਵਲ ਮਨਜ਼ੂਰਸ਼ੁਦਾ ਭਰਾਈ ਸਥਾਨ 'ਤੇ ਭਰਵਾਓ ਚੈੱਕ ਕਰਨ ਭਰਾਈ ਤੋਂ ਬਾਅਦ ਲੀਕ ਜਾਂ ਹੋਰ ਸਮੱਸਿਆਵਾਂ ਲਈ ਚੈੱਕ ਕਰੋ ਸੱਤਵਾਂ ਸੰਭਾਲ ਅਤੇ ਸੁਖਰਾ ਕਲੀਨਿੰਗ ਸਮੇਂ ਸਮੇਂ 'ਤੇ ਸਿਲੰਡਰ ਅਤੇ ਪਾਈਪਾਂ ਨੂੰ ਸਾਫ਼ ਕਰੋ ਮਿਆਦ ਆਪਣੇ ਸਿਲੰਡਰ ਨੂੰ ਬਦਲੋ ਅਤੇ ਮਿਆਦ ਸਮਾਪਤੀ ਦੀ ਜਾਂਚ ਕਰੋ ਇਹ ਸਭ ਹਿਸਾਬਦਾਨੀਆਂ ਸਲੰਡਰ ਦੀ ਸੁਰੱਖਿਆ ਅਤੇ ਕਾਰਜ ਗੁਰਜਾਰੀ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਹਨ ਇਹ ਰਹੀਆਂ ਕੁਝ ਹੋਰ ਹਿਸਾਬਦਾਨੀਆਂ ਅਤੇ ਸੁਝਾਵ ਜਿਨਾਂ ਨੂੰ ਗੈਸ ਸਿਲੰਡਰ ਦੀ ਵਰਤੋਂ ਕਰਨ ਵੇਲੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਸਿਲੰਡਰ ਦੀ ਸਟੋਰੇਜ ਠੰਡੇ ਅਤੇ ਸੁੱਕੇ ਸਥਾਨ ਸਿਲੰਡਰ ਨੂੰ ਹਮੇਸ਼ਾ ਸੁੱਕੇ ਸਥਾਨ ਵਿੱਚ ਰੱਖੋ